ਮੈਂ ਆਪਣੀ ਰੈਸਿਪੀ ਦੇ ਵਿੱਚ ਘਰ ਬਣਾਏ ਗਏ ਮਸਾਲੇ ਹੀ ਪਾਉਂਦੀ ਹਾਂ ਜਿਵੇਂ ਕਿ ਕੜ੍ਹੀ ਦੇ ਵਿੱਚ ਕੜ੍ਹੀ ਪੱਤਾ ਹੋ ਗਿਆ ਅਤੇ ਮਸਾਲਿਆਂ ਦੇ ਵਿੱਚ ਮੈਂ ਆਪਣੇ ਜ਼ੀਰੇ ਨੂੰ ਕੁੱਟ ਕੇ ਪਾਉਂਦੀ ਹਾਂ ਅਤੇ ਕੜ੍ਹੀ ਪੱਤੇ ਦਾ ਵੀ ਜੋ ਸ ਟੇਸਟ ਹੈ ਉਹ ਬਹੁਤ ਵਧੀਆ ਆਉਂਦਾ ਹੈ ਮਸਾਲੇ ਕਈ ਤਰ੍ਹਾਂ ਦੇ ਮਸਾਲੇ ਹੈ ਜੋ ਕਿ ਇੱਕ ਮਤਲਬ ਅਸਧਾਰਨ ਹੀ ਹੈ ਜੋ ਕਿ ਇੱਕ ਸਬਜ਼ੀ ਨੂੰ ਬਹੁਤ ਵਧੀਆ ਜਿਹੜਾ ਟੇਸਟ ਹੈ ਸਵਾਦ ਹੈ ਉਹ ਪ੍ਰਦਾਨ ਕਰਦੀਆਂ ਹਨ ਮੇਰੇ ਮਸ ਸਬਜ਼ੀ ਦੇ ਵਿੱਚ ਕਈ ਤਰ੍ਹਾਂ ਦੇ ਇਹੋ ਜਿਹੇ ਮਸਾਲੇ ਹਨ